ਸੋ ਭੰਗੜੇ ਦੀ ਪ੍ਰਦਰਸ਼ਨ ਵਾਸਤੇ ਆਮ ਤੌਰ 'ਤੇ ਕੁੜਤਾ ਹੈ ਚਾਦਰਾ ਅਤੇ ਉਹਦੇ ਨਾਲ ਪਗੜੀ ਬੰਨ੍ਹੀ ਜਾਂਦੀ ਆ ਜੋ ਕਿ ਟੁਰਲੇ ਵਾਲੀ ਹੁੰਦੀ ਹੈ ਇਹ ਇੱਕ ਬਹੁਤ ਹੀ ਸੱਭਿਆਚਾਰਕ ਪੁਸ਼ਾਕ ਹੈ ਜੋ ਕਿ ਵਰਤਦੇ ਹਾਂ ਸੋ ਇਹਨਾਂ ਨੂੰ ਮੇਰੇ ਅਕੋਰਡਿੰਗ ਇਹਨਾਂ ਨੂੰ ਰੰਗ ਬਿਰੰਗੇ ਕਲਰ ਦੇ ਗੋਟੇ ਲਗਾ ਕੇ ਅਲੱਗ ਅਲੱਗ ਤਰ੍ਹਾਂ ਦੇ ਰੰਗ ਦੇ ਗੋੋਟੇ ਲਗਾ ਕੇ ਇਹਨਾਂ ਨੂੰ ਆਕਰਸ਼ਿਕ ਬਣਾਇਆ ਜਾਂਦਾ ਹੈ ਅਤੇ ਆਪਣੇ ਆਪ 'ਚ ਹੀ ਕੁੜਤਾ ਚਾਦਰਾ ਇੱਕ ਬਹੁਤ ਹੀ ਸੋਹਣਾ ਜਿਹਾ ਲੁਕ ਦਿੰਦਾ ਹੈ ਸੋ ਮੇਰੇ ਹਿਸਾਬ ਨਾਲ ਭੰਗੜੇ ਦਾ ਪ੍ਰਦਰਸ਼ਨ ਜੋ ਹੈ ਉਹਦਾ ਜੋ ਪਹਿਰਾਵਾ ਇਹ ਬਹੁਤ ਹੀ ਸੋਹਣਾ ਭਰਿਆ ਪਹਿਰਾਵਾ ਹੈ ਜਿਹਦੇ ਵਿੱਚ ਭੰਗੜੇ ਵਾਲੇ ਗੱਭਰੂ ਜੋ ਹਨ ਉਹ ਅਲੱਗ ਅਲੱਗ ਤਰ੍ਹਾਂ ਦੇ ਰੰਗ ਬਿਰੰਗੇ ਲਾਲ ਪੀਲੇ ਨੀਲੇ ਚਾਦਰੇ ਅਤੇ ਉਹਦੇ ਨਾਲ ਕੁੜਤੇ ਪਾ ਕੇ ਨਾਲ ਟੁਰਲੇ ਵਾਲੇ ਪਰਨੇ ਬੰਨ੍ਹ ਕੇ ਅਤੇ ਕੈਂਠਾ ਵੀ ਪਾਇਆ ਜਾਂਦਾ ਹੈ ਉਹ ਕੈਂਠਾ ਪਾਉਣਾ ਹੁੰਦਾ ਹੈ ਉਹ ਕੈਂਠੇ ਕੈਂਠੇ ਦੇ ਨਾਲ ਉਹਨਾਂ ਦੀ ਦਿੱਖ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਔਰ ਜਦੋਂ ਕੁੜਤਾ ਚਾਦਰਾ ਪਾ ਕੇ ਨੱਚਦੇ ਹਨ ਤਾਂ ਉਹ ਹੋਰ ਵੀ ਰੋਚਕ ਲੱਗਦਾ ਹੈ ਦੇਖਣ ਵਿੱਚ ਇਹ ਪੁਸ਼ਾਕ ਇੱਕ ਬਹੁਤ ਹੀ ਮਹੱਤਵਪੂਰਨ ਪੁਸ਼ਾਕ ਹੈ ਅਤੇ ਇਹ ਬਹੁਤ ਹੀ ਅੱਛੇ ਤਰੀਕੇ ਨਾਲ ਮੈਂ ਸਮਝਦੀ ਹਾਂ ਕਿ ਇਹਨੂੰ ਵਧੀਆ ਮੰਨਿਆ ਜਾਂਦਾ ਹੈ ਸੋ ਭੰਗੜੇ ਦਾ ਪ੍ਰਦਰਸ਼ਨ ਆਮ ਤੌਰ 'ਤੇ ਇਸ ਤਰੀਕੇ ਦੇ